ਕੁਝ ਨਹੀਂ ਬਹੁਤ ਸਾਰੇ ਕੋਰਸ ਹਨ ਜੋ ਕਿ ਸਾਨੂੰ ਤਕਨਾਲੋਜੀ ਅਤੇ ਕੰਪਿਊਟਰ ਬਾਰੇ ਸਿਖਾਉਂਦੇ ਹਨ ਬੇਸਿਕ ਕੋਰਸ ਕੰਪਿਊਟਰ ਅਤੇ ਤਕਨਾਲੋਜੀ ਨਾਲ ਸੰਬੰਧਿਤ ਜਿਵੇਂ ਕਿ ਟੈਲੀ ਟੈਲੀ ਕੋਰਸ ਕੰਪਿਊਟਰ ਬੇਸਿਕ ਔਰ ਕੰ ਬੇਸਿਕ ਸਿੱਖਣ ਲਈ ਕੰਪਿਊਟਰ ਅਤੇ ਤਕਨਾਲੋਜੀ ਕੋਰਸ ਅਤੇ ਅਤੇ ਅਕਾਊਂਟ ਅਕਾਊਂਟ ਟਾਈਪਿੰਗ ਇਹ ਸਭ ਬੇਸਿਕ ਕੋਰਸ ਜੋ ਕਿ ਸਾਨੂੰ ਤਕਨਾਲੋਜੀ ਅਤੇ ਕੰਪਿਊਟਰ ਬਾਰੇ ਸਿਖਾਉਂਦੇ ਹਨ ਸਕੂਲਾਂ ਦੇ ਵਿੱਚ ਕੁਝ ਕੁ ਪ੍ਰੋਫੈਸ਼ਨਲ ਕੋਰਸ ਕੰਪਿਊਟਰ ਕੋਰਸ ਆ ਜਾਂਦੇ ਹਨ ਜਿਵੇਂ ਕਿ ਬੀ ਸੀ ਏ ਬੀ ਟੈਕ ਜੋ ਕਿ ਤਕਨਾਲੋਜੀ ਅਤੇ ਕੰਪਿਊਟਰ ਨਾਲ ਸੰਬੰਧਿਤ ਹਨ ਜੋ ਕਿ ਕੰਪਿਊਟਰ ਨੂੰ ਕਿਸ ਤਰ੍ਹਾਂ ਚਲਾਇਆ ਜਾਂਦਾ ਹੈ ਅਤੇ ਬਣਾਇਆ ਜਾਂਦਾ ਹੈ ਜਾਂ ਉਸ ਦੁਆਰਾ ਕੰਮ ਕਿਵੇਂ ਕੀਤਾ ਜਾਂਦਾ ਹੈ ਤਕਨਾਲੋਜੀ ਜੋ ਕਿ ਨਵੇਂ ਨਵੇਂ ਕੰਪਿਊਟਰਾਂ ਦੁਆਰਾ ਕੰਮ ਕਰਨ ਦੇ ਨਵੇਂ ਨਵੇਂ ਤਰੀਕਿਆਂ ਨੂੰ ਸਿਖਾਇਆ ਜਾਂਦਾ ਹੈ ਕੁਝ ਪ੍ਰੋਫੈਸ਼ਨਲ ਕੋਰਸ ਬੀ ਸੀ ਏ ਬੀ ਬੀ ਟੈਕ ਇਹ ਸਭ ਇੰਜੀਨੀਅਰਿੰਗ ਅਤੇ ਤਕਨਾਲੋਜੀ ਨਾਲ ਸੰਬੰਧਿਤ ਹਨ ਸਕੂਲਾਂ ਦੇ ਵਿੱਚ ਕੰਪਿਊਟਰ ਬਾਰੇ ਪੜ੍ਹਾਇਆ ਜਾਂਦਾ ਹੈ ਜਿਸ ਵਿੱਚ ਕੰਪਿਊਟਰ ਵਿਸ਼ੇ ਬਾਰੇ ਕੁਝ ਬੇਸਿਕ ਜਾਣਕਾਰੀ ਦਿੱਤੀ ਜਾਂਦੀ ਹੈ ਅਤੇ ਜ਼ਿਆਦਾਤਰ ਥਰੈਟੀਕਲ ਵਰਕ ਕੰਮ ਕਰਵਾਇਆ ਜਾਂਦਾ ਹੈ ਸਕੂਲਾਂ ਦੇ ਵਿੱਚ ਬੱਚਿਆਂ ਨੂੰ ਕੰਪਿਊਟਰ ਦੀਆਂ ਕੰਪਿਊਟਰ ਦੀਆਂ ਕੀਜ ਬਾਰੇ ਦੱਸਿਆ ਜਾਂਦਾ ਹੈ ਅਤੇ ਉਸ ਵਿੱਚ ਕੰਪਿਊਟਰ ਦੁਆਰਾ ਆਪਾਂ ਕੀ ਆਪਾਂ ਅੱਗੇ ਜਾ ਕੇ ਕੀ ਕੰਮ ਕਰ ਸਕਦੇ ਹਾਂ ਉਸ ਬਾਰੇ ਦੱਸਿਆ ਜਾਂਦਾ ਹੈ ਬੱਚੇ ਇਸ ਵਿੱਚ ਕੰਪਿਊਟਰ ਨੂੰ ਸਿਖਣ ਵਿੱਚ ਰੁਚੀ ਰੱਖਦੇ ਹਨ